ਮੈਂ ਕੋਈ ਵੀ ਇੰਡੀਅਨ ਆਈਡੀਅਲ ਵਰਗੇ ਸੰਗੀਤ ਰਿਆਲਿਟੀ ਸ਼ੋਅ ਨਹੀਂ ਦੇਖਦੀ ਅਤੇ ਇਸ ਬਾਰੇ ਮੇਰਾ ਵਿਚਾਰ ਇਹ ਹੈ ਕਿ ਜਿਸ ਖੇਤਰ ਵਿਚ ਬਹੁਤ ਜ਼ਿਆਦਾ ਅਸੀਂ ਨਾ ਜਾਣਦੇ ਹੋਈਏ ਤਾਂ ਉਸ ਬਾਰੇ ਬੋਲਣਾ ਵੀ ਮੁਸ਼ਕਿਲ ਹੁੰਦਾ ਹੈ